ਬੱਚਿਆਂ ਨੂੰ ਸਕੂਲ ਦੇ ਸਿਲੇਬਸ ਵਿੱਚ ਬੈਂਕ ਦੇ ਵਰਕਫਲੋ ਨੀਤੀਆਂ ਕਰਜ਼ੇ ਰਿਟਰਨ ਟੈਕਸ ਆਦਿ ਬਾਰੇ ਸਿਖਾਉਣ ਦੀ ਬਹੁਤ ਲੋੜ ਹੈ ਅਗਰ ਮੈਂ ਸਾਡੇ ਟਾਈਮ ਦੀ ਗੱਲ ਕਰਾਂ ਤਾਂ ਸਾਨੂੰ ਕਿਸੇ ਨੇ ਬੈਂਕ ਦਾ ਬਾਊਚਰ ਭਰਨਾ ਨਹੀਂ ਸਿਖਾਇਆ ਤੱਸ ਅਸੀਂ ਉਹ ਪੁੱਛ ਗਿੱਛ ਕੇ ਆਸ ਪਾਸ ਤੋਂ ਵੈਸੇ ਤਾਂ ਖੁਦ ਹੀ ਭਰਨਾ ਸਿੱਖਿਆ ਹੈ ਇੱਕ ਦੂਜੇ ਨੂੰ ਦੇਖ ਕੇ ਪਰ ਸਾਨੂੰ ਕਿਸੇ ਨੇ ਸਿਖਾਇਆ ਨਹੀਂ ਇਸ ਕਰਕੇ ਹੁਣ ਵਾਲੀ ਪੀੜ੍ਹੀ ਨੂੰ ਬਹੁਤ ਹੀ ਲੋੜ ਹੈ ਕਿਉਂਕਿ ਜਦੋਂ ਪੁਰਾਣਾ ਟਾਈਮ ਸੀ ਅਸੀਂ ਪੜ੍ਹਦੇ ਹੁੰਦੇ ਸੀਗੇ ਸਕੂਲ ਦੇ ਵਿੱਚ ਤਾਂ ਅਸੀਂ ਫੱਟੀਆਂ ਪੋਚਦੇ ਹੁੰਦੇ ਸੀਗੇ ਫੇਰ ਸਕੂਲ ਫੇਰ ਕੋਪੀਆਂ 'ਤੇ ਆਏ ਫੇਰ ਅਸੀਂ ਹੌਲੀ ਹੌਲੀ ਕੰਪਿਊਟਰ 'ਤੇ ਆ ਗਏ ਬਹੁ ਜਦੋਂ ਅਸੀਂ ਪੜ੍ਹਦੇ ਸੀ ਪਰ ਉਦੋਂ ਕੰਪਿਊਟਰ ਦਾ ਜਿਹੜਾ ਸਿਸਟਮ ਸੀ ਬਹੁਤ ਹੌਲੀ ਸੀਗਾ ਪਰ ਜਿਉਂ ਜਿਉਂ ਤਰੱਕੀ ਹੁੰਦੀ ਗਈ ਜਿਹੜਾ ਕੰਪਿਊਟਰ ਦਾ ਪ੍ਰੋਸੈਸ ਵੀ ਆ ਉਹ ਤੇਜ਼ ਹੋ ਗਿਆ ਤੇਜ਼ ਦੇ ਹੋਣ ਨਾਲ ਬੱਚੇ ਵੀ ਤੇਜ਼ ਹੋ ਗਏ ਅੱਜ ਕੱਲ੍ਹ ਫਸਟ ਤੋਂ ਹੀ ਕੰਪਿਊਟਰ ਨੂੰ ਪੜ੍ਹਾਉਣਾ ਸ਼ੁਰੂ ਹੋ ਜਾਂਦਾ ਹੈ ਛੋਟੇ ਬੱਚੇ ਹੀ ਬਹੁਤ ਕੰਪਿਊਟਰ ਬਾਰੇ ਬਹੁਤ ਨੋਲੇਜ ਰੱਖਦੇ ਆ ਛੋਟੇ ਛੋਟੇ ਬੱਚੇ ਵੀ ਤਾਂ ਉਹਨਾਂ ਨੂੰ ਬੈਂਕ ਦੇ ਬਾਊਚਰ ਰਿਟਰਨ ਟੈਕਸ ਕਿਵੇਂ ਪੇ ਕਰਨਾ ਹੈਗਾ ਸਾਰੀ ਜਾਣਕਾਰੀ ਸਾਨੂੰ ਦੇ ਦੇਣੀ ਚਾਹੀਦੀ ਹੈਗੀ ਆਦਿ ਸਕੂਲ ਦੇ ਸਿਲੇਬਸ ਦੀ ਗੱਲ ਕਰਾਂ ਤਾਂ ਮੈਂ ਇਹ ਸੋਚਦੀ ਹਾਂ ਅਗਰ ਬੱਚਾ ਦਸਵੀਂ ਤੋਂ ਬਾਅਦ ਕੋਈ ਗਰੀਬ ਘਰੋਂ ਉਹ ਪੜ੍ਹ ਨਹੀਂ ਸਕਦਾ ਪਰ ਉਹਨੂੰ ਬੈਂਕ ਦੀ ਨੀਤੀ ਦਾ ਕੋਈ ਵੀ ਪਤਾ ਨਹੀਂ ਤਾਂ ਉਹਦੀ ਜ਼ਿੰਦਗੀ ਖ਼ਰਾਬ ਹੈ ਇਸ ਲਈ ਉਹਨੂੰ ਬੈਂਕ ਦਾ ਤਾਂ ਕੁਛ ਨਾ ਕੁਛ ਪਤਾ ਹੋਣਾ ਚਾਹੀਦਾ ਅਗਰ ਬੈਂਕ ਦਾ ਕੁਛ ਪਤਾ ਹੋਊਗਾ ਵੀ ਵਿਆਜ ਕਿਵੇਂ ਕੱਢਣਾ ਹੈ ਟੈਕਸ ਕਿਵੇਂ ਪੇ ਕਰਨੇ ਹੈ ਤਾਂ ਉਹਦੀ ਜ਼ਿੰਦਗੀ ਅਸਾਨ ਹੋ ਜਾਵੇਗੀ ਸੋ ਇਸ ਲਈ ਮੈਂ ਇਹੀ ਕਹਿਣਾ ਚਾਹੁੰਦੀ ਹਾਂ ਵੀ ਬੱਚ ਦਸਵੀਂ ਤੋਂ ਬਾਅਦ ਬੱਚਿਆਂ ਨੂੰ ਇਹ ਸਾਰੀਆਂ ਚੀਜ਼ਾਂ ਆਉਣੀਆਂ ਬਹੁਤ ਜ਼ਰੂਰੀ ਹੈ ਵੈਸੇ ਤਾਂ ਗੱਲ ਕਰਾਂ ਤਾਂ ਇਹ ਪਹਿਲਾਂ ਹੀ ਹੋਣਾ ਚਾਹੀਦਾ ਹੈ ਅਗਰ ਕੋਈ ਨਹੀਂ ਕਰ ਸਕਦਾ ਤਾਂ ਉਹ ਇਸ ਚੀਜ਼ ਨੂੰ ਜ਼ਰੂਰ ਕਰੇ ਸੋ ਥੈਂਕ ਯੂ ਧੰਨਵਾਦ